ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਣ ਬੋਲ ਰਹੇ ਹੋ ਅੱਛਾ ਜੀ ਹਾਂਜੀ ਹਾਂਜੀ ਵੇਖੋ ਜੀ ਇਹ ਤਾਂ ਮਤਲਬ ਕੀ ਪੰਜਾਬ ਦੇ ਅੰਦਰ ਇਲਾਕਿਆਂ 'ਚ ਮੀਂਹ ਨਹੀਂ ਪਿਆ ਸੀ ਨਾ ਬਟ ਜਿਹੜਾ ਪਹਾੜੀ ਇਲਾਕਾ ਜਦੋਂ ਉਤਰਾਖੰਡ ਵਾਲੀ ਸਾਈਡ ਵਾਲਾ ਇਲਾਕਾ ਉੱਥੇ ਬਹੁਤ ਮੀਂਹ ਪਿਆ ਸੀ ਜਿਸ ਕਰਕੇ ਜਿਹੜਾ ਡੈਮ ਅਤੇ ਉਹ ਪੂਰਾ ਭਰ ਗਿਆ ਸੀ ਇਸ ਕਰਕੇ ਸਾਨੂੰ ਕੁਛ ਕੁ ਬੰਨ ਖੋਲਣੇ ਪਏ ਨਹੀਂ ਮੈਮ ਵੇਖੋ ਜੀ ਅਸੀਂ ਉਹ ਬੰਨ੍ਹ ਨਾ ਖੋਲ੍ਹਦੇ ਤਾਂ ਸਾਰਾ ਪੰਜਾਬ ਹੀ ਡੁੱਬ ਜਾਣਾ ਸੀ ਇਸ ਲਈ ਸਾਨੂੰ ਸਮੇਂ ਸਮੇਂ 'ਤੇ ਇਹ ਜਿਹੇ ਫੈਸਲੇ ਲੈਣੇ ਪੈਂਦੇ ਨੇ ਜੇ ਅਸੀਂ ਉਹ ਬੰਨ੍ਹ ਨਾਂ ਖੋਲ੍ਹੇ ਤਾਂ ਸਾਰਾ ਪੰਜਾਬ ਦਾ ਨੁਕਸਾਨ ਹੋਣਾ ਸੀ ਹੁਣ ਕੁਛ ਕੁ ਇਲਾਕਿਆਂ ਦਾ ਹੋਇਆ ਹੈ ਹਾਂਜੀ ਮੈਮ ਅਸੀਂ ਤਾਂ ਇਹ ਹੀ ਗੱਲਾਂ ਲੋਕਾਂ ਨੂੰ ਸਮਝਾਉਂਦੇ ਹਾਂ ਪਰ ਚਲੋ ਚੰਗਾ ਤੁਹਾਡੇ ਆਰਟੀਕਲ ਰਾਹੀਂ ਲੋਕਾਂ ਨੂੰ ਕੁਛ ਜਾਗਰੂਕਤਾ ਮਿਲੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਪੰਜਾਬ ਦਾ ਹਰ ਧਰਤੀ ਹੇਠਲਾ ਪਾਣੀ ਹੈ ਉਸਦਾ ਸਤਰ ਬਹੁਤ ਹੀ ਘਟਦਾਦਾ ਜਾ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਬੋਰਵੈਲ ਦਾ ਪਾਣੀ ਘੱਟ ਵਰਤਣ ਅਤੇ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣ ਉਸਦੀ ਹੀ ਵਰਤੋਂ ਕਰਨ ਸੰਚਾਈ ਵਾਸਤੇ

ਅਤੇ ਦੂਜਾ ਇਹ ਹੋਣਾ ਚਾਹੀਦਾ ਕਿ ਕਿਸਾਨ ਨੂੰ ਇੱਕ ਹੀ ਫ਼ਸਲ ਨਹੀਂ ਕਰਨੀ ਚਾਹੀਦੀ ਉਹਨੂੰ ਟਾਈਮ ਸਮੇਂ ਦੇ ਸਿਰ ਫ਼ਸਲ ਬਦਲਦੀ ਰਹਿਣੀ ਚਾਹੀਦੀ ਹੈ ਜਿਸ ਕਰਕੇ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਹੈ ਉਹ ਵੀ ਮਤਲਬ ਕਿ ਵਧੀਆ ਰਹਿੰਦੀ ਹੈ ਉਹ ਨਸ਼ਟ ਨਹੀਂ ਹੁੰਦੀ ਹਾਂਜੀ ਬਿਲਕੁਲ ਬਿਲਕੁਲ ਇਕ ਤੁਸੀਂ ਆ ਵੀ ਲਿਖ ਦਿਓ ਕਿ ਕਿਸਾਨਾਂ ਨੂੰ ਨਾ ਝੋਨੇ ਦੀ ਫ਼ਸਲ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਝੋਨੇ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਇਸ ਨਾਲ ਪਾਣੀ ਦੀ ਬਹੁਤ ਹੀ ਜ਼ਿਆਦਾ ਖਪਤ ਹੁੰਦੀ ਹੈ ਦੇਖੋ ਜੀ ਉੱਥੇ ਵੀ ਹੜ੍ਹ ਦੇ ਹਾਲਾਤਾਂ ਤਾਂ ਬਣੇ ਹੀ ਹੋਏ ਸੀ ਜੇ ਅਸੀਂ ਉਹ ਬੰਨ ਨਾਂ ਖੋਲ੍ਹਦੇ ਤਾਂ ਉੱਤਰਾਖੰਡ ਦੇ ਨਾਲ ਨਾਲ ਪੰਜਾਬ ਵੀ ਡੁੱਬਣਾ ਸੀ ਹੁਣ ਇਕੱਲਾ ਪੰਜਾਬ ਦਾ ਕੁਛ ਕੁਛ ਹਿੱਸਾ ਹੀ ਹੜ੍ਹ ਦੇ ਨਾਲ ਭਰਿਆ ਆ ਨੁਕਸਾਨ ਹੋਇਆ ਜੇ ਅਸੀਂ ਉਹ ਕਦਮ ਨਾਂ ਚੁੱਕਦੇ ਤਾਂ ਜ਼ਿਆਦਾ ਜਾਨ ਹਾਨੀ ਹੋਣੀ ਸੀ ਜੋ ਕਿ ਹੁਣ ਜਿੰਨੀ ਹੋਈ ਹੈ ਉਸ ਤੋਂ ਬਹੁਤ ਜ਼ਿਆਦਾ ਹੋਣੀ ਸੀ ਇਸ ਲਈ ਸਾਨੂੰ ਇਹ ਕਦਮ ਚੁੱਕਣਾ ਪਿਆ ਹਾਂਜੀ ਬਿਲਕੁਲ ਸਰਕਾਰ ਦੁਆਰਾ ਉਹਨਾਂ ਨੂੰ ਪੈਸੇ ਦਿੱਤੇ ਗਏ ਨੇ ਹਾਂਜੀ ਜ਼ਰੂਰ ਸਤਿ ਸ਼੍ਰੀ ਆਕਾਲ